ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਨੇ ਕਸੌਲੀ ਘੁੰਮਣ ਜਾਣਾ ਜੀ ਆਪਾਂ ਨੂੰ ਗੱਡੀ ਚਾਹੀਦੀ ਹੈ ਜੀ ਤੁਸੀਂ ਰੇਟ ਦੱਸ ਦੱਸ ਸਕਦੇ ਹੋ ਮੈਨੂੰ ਸਕੋਰਪੀਓ ਦਾ ਕਿਆ ਰੇਟ ਹੈ ਭਾਅ ਜੀ ਠੀਕ ਹੈ ਜੀ ਅਤੇ ਜੇ ਆਪਾਂ ਛੋਟੀ ਗੱਡੀ ਕਰਨੀ ਹੋਵੇ ਆਲਟੋ ਵਗੈਰਾ ਠੀਕ ਹੈ ਜੀ ਅਤੇ ਜੇ ਆਪਾਂ ਨੂੰ ਦੋ ਦਿਨਾਂ ਵਾਸਤੇ ਚਾਹੀਦੀ ਹੋਵੇ ਗੱਡੀ ਅਤੇ ਫੇਰ ਕੁਝ ਲੈੱਸ ਕਰੋਂਗੇ ਅੱਛਾ ਜੀ ਅਤੇ ਜੋ ਡਰਾਈਵਰ ਹੋਵੇਗਾ ਨਾਲ ਫਿਰ ਉਹਦਾ ਖਰਚਾ ਸਾਨੂੰ ਕਰਨਾ ਪੈਣਾ ਹੈ ਜਾਂ ਉਹ ਆਪਣਾ ਖਰਚਾ ਖ਼ੁਦ ਕਰੂ ਅੱਛਾ ਜੀ ਅਤੇ ਬਾਕੀ ਆਪਾਂ ਨੂੰ ਜੇ ਜੇ ਮੰਨ ਲਉ ਵੀ ਆਪਾਂ ਨੂੰ ਘਰ ਤੋਂ ਪਿੱਕ ਕਰਨਾ ਹੋਵੇ ਗੱਡੀ ਨੇ ਅਤੇ ਘਰ ਤੋਂ ਪਿੱਕ ਕਰੇਗੀ ਜਾਂ ਸਾਨੂੰ ਤੁਹਾਡੇ ਕੋਲ ਆਉਣਾ ਪਵੇਗਾ ਨਾ ਗੱਡੀ ਸਾਨੂੰ ਘਰ ਤੋਂ ਪਿੱਕ ਕਰਕੇ ਲੈ ਜਾਵੇਗੀ ਜਾਂ ਸਾਨੂੰ ਤੁਹਾਡੇ ਤੱਕ ਆਉਣਾ ਪੈਣਾ ਅੱਛਾ ਜੀ ਮੰਨ ਲਉ ਜੇ ਆਪਾਂ ਨੂੰ ਰਾਤ ਨੂੰ ਬੁਲਾਉਣੀ ਪੈ ਗਈ ਗੱਡੀ ਤਾਂ ਰਾਤ ਨੂੰ ਵੀ ਆ ਸਕਦੇ ਹਾਂ ਅੱਛਾ ਸਵੇਰ ਨੂੰ ਰਾਤ ਨੂੰ ਠੀਕ ਹੈ ਜੀ ਅਤੇ ਜੇ ਮੰਨ ਲਉ ਵੀ ਆਪਾਂ ਨੂੰ ਬੱਸ ਚਾਹੀਦੀ ਹੋਈ ਠੀਕ ਹੈ ਟਰੈਵਲਰ ਟਰੈਵਲਰ ਟੈਂਪੂ ਚਾਹੀਦਾ ਤਾਂ ਉਹ ਵੀ ਅਵੇਲੇਵਲ ਹੈ ਤੁਹਾਡੇ ਕੋਲ ਠੀਕ ਹੈ ਜੀ ਅਤੇ ਸਾਡੇ ਜਿੰਨ੍ਹੇ ਵੀ ਬੰਦੇ ਹੋਣਗੇ ਨਾਲ਼ ਅਤੇ ਜੋ ਤੁਹਾਡਾ ਡਰਾਈਵਰ ਹੈ ਕੋਈ ਡਿਸਟਰਬ ਤਾਂ ਨਹੀਂ ਕਰੇਗਾ ਤੁਹਾਡੇ ਡਰਾਈਵਰ ਸਹੀ ਹੈ ਓਕੇ ਠੀਕ ਹੈ ਅਤੇ ਤੁਹਾਡੇ ਡਰਾਈਵਰਾਂ ਦੀ ਸਰਵਿਸ ਕਿਵੇਂ ਹੈ ਠੀਕ ਹੈ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੋਲ ਕਰਕੇ ਦੱਸ ਦੇਵਾਂਗਾ